ਅਗਰ ਮੈਨੂੰ ਮੌਕਾ ਮਿਲੇ ਤਾਂ ਮੈਂ ਆਪਣੇ ਪਿੰਡ ਆਪਣੇ ਇਲਾਕੇ ਦੇ ਕਿਸਾਨਾਂ ਲਈ ਇਹ ਕਰਨਾ ਚਾਹਵਾਂਗੀ ਕਿ ਮੈਂ ਉਹਨਾਂ ਨੂੰ ਲੋਨ ਜਾਂ ਸਬਸਿਡੀ ਦਿਵਾ ਸਕਾਂ ਜਿਨ੍ਹਾਂ ਕਰਕੇ ਉਹ ਆਪਣੀ ਖੇਤੀਬਾੜੀ ਅਪ ਆਪਣੀ ਮਰਜ਼ੀ ਨਾਲ ਕਰ ਸਕਣ ਅਤੇ ਵਧੀਆ ਉੱਥੋਂ ਮੁਨਾਫਾ ਪਾ ਸਕਣ ਅਤੇ ਮਜ਼ਦੂਰਾਂ ਲਈ ਮੈਂ ਇਹ ਕਰਨਾ ਚਾਹਵਾਂਗੀ ਕਿ ਮਜ਼ਦੂਰਾਂ ਲਈ ਮੈਂ ਉੱਦਾਂ ਦੇ ਰੁਜ਼ਗਾਰ ਰੱਖਾਂਗੀ ਤਾਂ ਕਿ ਉਹਨਾਂ ਨੂੰ ਮਜ਼ਦੂਰੀ ਨੂੰ ਉਹਨਾਂ ਮਜ਼ਦੂਰਾਂ ਨੂੰ ਮਜ਼ਦੂਰ ਮਿਲ ਸਕੇ ਅਤੇ ਚੰਗੇ ਪੈਸੇ ਕਮਾ ਸਕਣ